ਮੈਂ ਇੱਕ ਔਨਲਾਈਨ ਸੂਟ ਔਡਰ ਕੀਤਾ ਸੀ ਜਿਸਦੀ ਕੀਮਤ ਛੇ ਸੌ ਰੁਪਏ ਸੀ ਪਰ ਮੈਂ ਔਡਰ ਕਰਨ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਦੋ ਸੌ ਰੁਪਇਆ ਕੀਤਾ ਜਦੋਂ ਉਹਨਾਂ ਨੂੰ ਮੈਂ ਦੋ ਸੌ ਰੁਪਇਆ ਕੀਤਾ ਤਾਂ ਉਹਨਾਂ ਨੇ ਕਿਹਾ ਕੀ ਇਹ ਕੈਸ਼ ਔਨ ਡਿਲੀਵਰੀ ਨਹੀਂ ਹੈ ਤਾਂ ਤੁਸੀਂ ਸਾਰੀ ਪੇਮੈਂਟ ਇੱਕੋ ਵਾਰ 'ਚ ਕਰਨੀ ਹੈ ਪਰ ਮੈਂ ਉਹਨਾਂ 'ਤੇ ਥੋੜ੍ਹਾ ਟਰੱਸਟ ਨਾ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਦੋ ਸੌ ਰੁਪਈਆ ਸੈਂਡ ਕੀਤਾ ਜਿਸ ਨਾਲ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਤੋਂ ਔਡਰ ਕੈਂਸਲ ਕਰਵਾ ਦਿੱਤਾ ਅਤੇ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਅਗਰ ਔਡਰ ਕੈਂਸਲ ਕੀਤਾ ਹੈ ਤੁਸੀਂ ਆਪਣਾ ਦੋ ਸੌ ਰੁਪਈਆ ਰੀਵਿਊ ਲੈਣਾ ਹੈ ਤਾਂ ਤੁਹਾਨੂੰ ਪਹਿਲਾਂ ਪੂਰੀ ਕੀਮਤ ਛੇ ਸੌ ਰੁਪਏ ਸੂਟ ਦੀ ਫਿਲ ਕਰਨੀ ਪਏਗੀ ਪਰ ਮੈਂ ਉਹਨਾਂ ਨੂੰ ਮਨ੍ਹਾ ਕਰਦੇ ਹੋਏ ਉਹਨਾਂ ਨੇ ਮੈਨੂੰ ਇੱਕ ਝਾਂਸਾ ਦਿੱਤਾ ਕਿ ਤੁਸੀਂ ਦੋ ਸੌ ਰੁਪਈਆ ਵਾਪਿਸ ਕਰਨ ਲਈ ਕਰੋਗੇ ਤਾਂ ਤੁਹਾਡੇ ਤੋਂ ਕੋਈ ਪੇਮੈਂਟ ਨਹੀਂ ਲਈ ਜਾਵੇਗੀ ਅਤੇ ਉਹਨਾਂ ਨੇ ਮੈਨੂੰ ਦੋ ਸੌ ਰੁਪਈਆ ਜਦੋਂ ਵਾਪਸ ਕੀਤਾ ਤਾਂ ਗਲਤੀ ਨਾਲ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਹਾਨੂੰ ਦੋ ਹਜ਼ਾਰ ਰੁਪਈਆ ਪੈ ਗਿਆ ਹੈ ਜਿਸ ਨਾਲ ਤੁਹਾਡੀ ਤੁਸੀਂ ਸਾਨੂੰ ਅਠਾਰ੍ਹਾਂ ਸੌ ਰੁਪਇਆ ਵਾਪਸ ਕਰ ਦੇਵੋ ਅਤੇ ਦੋ ਸੌ ਰੁਪਇਆ ਆਪਣਾ ਰੱਖ ਲਵੋ ਪਰ ਜਦੋਂ ਮੈਂ ਆਪਣੇ ਅਕਾਊਂਟ ਵਿੱਚ ਚੈੱਕ ਕੀਤਾ ਤਾਂ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਆਇਆ ਹੋਇਆ ਜਿਸ ਨਾਲ ਮੈਂ ਕਿਹਾ ਕਿ ਜਿਸ ਨਾਲ ਮੇਰੇ ਦੋ ਦੋ ਹਜ਼ਾਰ ਦੋ ਸੌ ਰੁਪਏ ਦਾ ਨੁਕਸਾਨ ਹੋਇਆ ਪਰ ਉਸਦੇ ਨਾਲ ਹੀ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਤੁਸੀਂ ਦੋ ਸੌ ਰੁਪਈਆ ਸੈਂਡ ਕਰਦੇ ਹੋ ਤਾਂ ਨਹੀਂ ਉਦੋਂ ਤੱਕ ਨਹੀਂ ਦਿਸਣਗੇ ਜਦੋਂ ਤੱਕ ਤੁਸੀਂ ਹੈ ਨਾ ਬਾਰਾਂ ਸੌ ਸੱਠ ਰੁਪਈਆ ਹੋਰ ਨਹੀਂ ਕਰੋਗੇ ਜੇਕਰ ਮੈਂ ਉਨ੍ਹਾਂ ਮੈਂ ਗਲਤੀ ਨਾਲ ਬਾਰਾਂ ਸੌ ਸੱਠ ਰੁਪਇਆ ਵੀ ਕਰ ਦਿੱਤਾ ਜਿਸ ਨਾਲ ਮੈਨੂੰ ਕੋਈ ਸਗੋਂ ਦੋ ਸੌ ਰੁਪਈਆ ਤਾਂ ਨਹੀਂ ਪਰ ਉਹਨਾਂ ਨਾਲ ਮੇਰਾ ਬਾਰਾਂ ਸੌ ਦਾ ਵੀ ਹੋਰ ਨੁਕਸਾਨ ਹੋ ਗਿਆ ਅਤੇ ਮੈਂ ਉਹਨਾਂ ਨੇ ਬਾਅਦ ਵਿੱਚ ਮੇਰਾ ਨੰਬਰ ਵੀ ਬਲੋਕ ਕਰ ਦਿੱਤਾ ਜਿਸ ਨਾਲ ਮੈਨੂੰ ਬਹੁਤ ਦੁੱਖ ਹੋਇਆ ਕਿ ਮੇਰੇ ਨਾਲ ਉਹਨਾਂ ਨੇ ਇਸ ਗੱਲ ਪਿੱਛੇ ਫਰੋਡ ਕੀਤਾ ਹੈ